ਸਤਿ ਸ਼੍ਰੀ ਅਕਾਲ ਮੈਂ ਇੰਟਰਨੈੱਟ ਚਲਾਣਾ ਸ਼ੁਰੂ ਕੀਤਾ ਸੀ ਆਪਣੇ ਦਸ ਸਾਲ ਦੀ ਉਮਰ ਵਿੱਚ ਮੈਨੂੰ ਜਦੋਂ ਮੈਂ ਇਹਦੇ ਬਾਰੇ ਮੈਨੂੰ ਪਤਾ ਲੱਗਿਆ ਇੰਟਰਨੈਟ ਬਾਰੇ ਇਹਦੇ ਵਿੱਚ ਬਹੁਤ ਹੀ ਇਹਦਾ ਬਹੁਤ ਹੀ ਫਾਇਦਾ ਹੈ ਸਾਨੂੰ ਹਰ ਇੱਕ ਚੀਜ਼ ਦੇ ਬਾਰੇ ਪਤਾ ਲੱਗ ਜਾਂਦਾ ਆਪਣੇ ਪੂਰੀ ਦੁਨੀਆਂ ਵਿੱਚ ਕੀ ਹੋ ਰਿਹਾ ਆਪਾਂ ਇੰਟਰਨੈਟ ਦੇ ਵਜਹਾ ਨਾਲ ਆਪਾਂ ਪਤਾ ਕਰ ਲੈਨੇ ਆ ਕਿਉਂਕਿ ਇਹਦੇ ਇਹਦੇ ਕਰਕੇ ਸਾਨੂੰ ਨਿਊਜ਼ ਦਾ ਸਭ ਕੁਝ ਪਤਾ ਚੱਲ ਜਾਂਦਾ ਇੰਟਰਨੈਟ ਨਾਲ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਤੇ ਜਦੋਂ ਮੈਂ ਇੰਟਰਨੈਟ ਚਲਾਣਾ ਸ਼ੁਰੂ ਕੀਤਾ ਉਸ ਲਈ ਹੀ ਟੂ ਜੀ ਤੇ ਟੂ ਜੀ ਵਿੱਚ ਕੀ ਹੁੰਦਾ ਸੀ ਕੀ ਇੰਨੀ ਰੇਂਜ ਨਹੀਂ ਸੀ ਆਉਂਦੀ ਕਿਉਂਕਿ ਇੰਨਾ ਟੈਕਨੋਲੋਜੀ ਨਹੀਂ ਕੀ ਜੋ ਟਾਵਰ ਹੀ ਇੰਨੇ ਟਾਵਰ ਨਹੀਂ ਹੀ ਤੇ ਟੂ ਜੀ ਨਾਲ ਕੀ ਹੁੰਦਾ ਸੀ ਕਿ ਸਪੀਡ ਥੋੜੀ ਸਲੋ ਹੁੰਦੀ ਤੇ ਵੀਡੀਓ ਜਿਹੜੀ ਹੁੰਦੀ ਸੀ ਉਹ ਰੁਕ ਰੁਕ ਕੇ ਚੱਲਦੀ ਸੀ ਫਿਰ ਥੋੜੇ ਟਾਈਮ ਤਿੰਨ ਚਾਰ ਸਾਲਾਂ ਬਾਅਦ ਆ ਗਿਆ ਥਰੀ ਜੀ ਫਿਰ ਥਰੀ ਜੀ ਵਿੱਚ ਕੀ ਹੋ ਗਿਆ ਕੀ ਥਰੀ ਜੀ ਵਿੱਚ ਥੋੜੀ ਸਪੀਡ ਜਿਆਦਾ ਹੋ ਗਈ ਤੇ

ਥੋੜੇ ਦੋ ਤਿੰਨ ਸਾਲ ਬਾਅਦ ਆ ਗਿਆ ਫੋਰ ਜੀ ਫੋਰ ਜੀ ਫੋਰ ਜੀ ਵਿੱਚ ਤਾਂ ਆਪਾਂ ਵੀਡੀਓ ਸਾਡੀ ਰੁਕਦੀ ਨਹੀਂ ਆ ਹਜੇ ਤੱਕ ਹੁਣ ਤੱਕ ਨਹੀਂ ਰੁਕਦੀ ਵੀਡੀਓ ਉਹਦੇ ਵਿੱਚ ਫੋਰ ਜੀ 'ਚ ਤੇ ਵੀਡੀਓ ਦੀ ਕੁਆਲਿਟੀ ਆਪਾਂ ਬਹੁਤ ਜਿਆਦਾ ਕਰਕੇ ਦੇਖ ਸਕਦੇ ਆਂ ਤੇ ਰੀਚਾਰਜ ਤੁਹਾਨੂੰ ਪਤਾ ਉਹ ਤੇ ਮਹਿੰਗੇ ਹੋਣੇ ਹੀ ਸੀ ਕਿਉਂਕਿ ਅਗਰ ਸਪੀਡ ਚਾਹੀਦੀ ਹ ਤੇ ਪੈਸੇ ਵੀ ਸਾਨੂੰ ਖਰਚਣੇ ਪੈਣੇ ਆ ਹੁਣ ਅੱਜ ਦੇ ਟਾਈਮ 'ਚ ਤੇ ਫਾਈਵ ਜੀ ਆ ਗਿਆ ਫਾਈਵ ਜੀ ਨਾਲ ਤੇ ਅਨਲਿਮਿਟਿਡ ਹੋ ਗਏ ਦਾ ਸਾਰਾ ਕੁਛ ਰੀਚਾਰਜ ਕਰਾਓ ਅਨਲਿਮਿਟ ਜਿੰਨਾ ਮਰਜ਼ੀ ਨੈਟ ਚਲਾਓ ਫਿਰ ਉਸ ਤੋਂ ਬਾਅਦ ਜਿੰਨੀ ਸਾਰਿਆਂ ਨਾਲੋਂ ਟੋਪ ਦੀ ਕੁਆਲਿਟੀ ਕਰਕੇ ਵੀਡੀਓ ਦੇਖ ਲਓ ਸਾਡਾ ਨੈਟ ਖਤਮ ਹੀ ਨਹੀਂ ਹੁੰਦਾ ਤੇ ਨਾ ਹੀ ਸਾਡੀ ਵੀਡੀਓ ਰੁਕਦੀ ਤੇ ਆਪਾਂ ਇਹੀ ਸਾਡੇ ਬਦਲਾਵ ਆਇਆ ਮੇਰੇ ਹੋਸ਼ ਦੇ ਵਿੱਚ ਵਿੱਚ ਕਿ ਇੰਟਰਨੈਟ ਵਿੱਚ ਕੀ ਹੋਇਆ ਟੂ ਜੀ ਤੋਂ ਫਾਈਵ ਜੀ ਆ ਗਿਆ ਨੈਟ